ਮੈਂ ਬਾਜ਼ਾਰ ਤੋਂ ਹੈਂਡ ਬਲੈਂਡਰ ਖਰੀਦਿਆ ਸੀ ਮੈਨੂੰ ਉਹ ਉਹਦੇ ਚਲਾਉਣ ਨਾਲ ਮੇਰਾ ਕੰਮ ਅੱਧਾ ਹੋ ਗਿਆ ਰਸੋਈ ਵਿੱਚ ਜਦੋਂ ਵੀ ਕੰਮ ਆਪਾਂ ਕਰਨਾ ਹੋਵੇ ਤਾਂ ਮੇਰਾ ਕੰਮ ਫਟਾਫਟ ਹੋ ਜਾਂਦਾ ਹੈ ਪਹਿਲਾਂ ਮੈਨੂੰ ਉਹਦੇ ਨਾਲ ਕੱਟਣ ਕਟਾਈ ਵਿੱਚ ਬਹੁਤ ਟਾਈਮ ਲੱਗਦਾ ਸੀ ਹੁਣ ਮੈਂ ਜਿਵੇਂ ਹੀ ਉਹਨੂੰ ਚਲਾਉਂਦੀ ਹਾਂ ਮੇਰਾ ਕੰਮ ਜਲਦੀ ਤੋਂ ਜਲਦੀ ਹੋ ਜਾਂਦਾ ਹੈ